ਛੇ ਜਨਵਰੀ ਦੋ ਹਜ਼ਾਰ ਅਠਾਰਾਂ ਛੱਬੀ ਜਨਵਰੀ ਦੋ ਹਜ਼ਾਰ ਸੌਲਾਂ ਤੀਹ ਅਕਤੂਬਰ ਦੋ ਹਜ਼ਾਰ ਗਿਆਰਾਂ ਚੌਵੀ ਜਨਵਰੀ ਦੋ ਹਜ਼ਾਰ ਉੱਨੀ ਇੱਕ ਅਕਤੂਬਰ ਦੋ ਹਜ਼ਾਰ ਬਾਰਾਂ